ਹੈਲੋ ਹਾਂਜੀ ਨਮਸਤੇ ਜੀ ਹਾਂਜੀ ਮੈਮ ਹਾਂਜੀ

ਹਾਂਜੀ ਹੋਰ ਮੈਮ ਹਾਂਜੀ ਹਾਂਜੀ ਕੋਈ ਨਹੀਂ ਮੈਮ ਮੈਂ ਕਲਾਸ 'ਚ ਫੇਰਾ ਮਾਰਾਂਗੀ ਫਿਰ ਦੇਖਾਂਗੇ ਹਾਂਜੀ ਹੋਰ ਕੋਈ ਪ੍ਰੋਬਲਮ ਹਾਂਜੀ ਕੋਈ ਨਹੀਂ

ਹਾਂਜੀ ਹਾਂਜੀ ਹੋਰ ਹੋਰ ਕੁਛ ਹਾਂਜੀ ਕੋਈ ਨਹੀਂ ਕੋਈ ਨਹੀਂ ਮੈਮ ਰਾਊਂਡ 'ਤੇ ਆਉਂਦੀ ਹਾਂ ਫਿਰ ਮੈਂ ਦੇਖਦੀ ਹਾਂ ਹੋਰ ਬੱਚਿਆਂ ਬਾਰੇ ਕੁਛ ਦੱਸੋ ਬੱਚਿਆਂ ਬਾਰੇ ਦੱਸੋ ਕੁਛ ਵੀ ਕਿਵੇਂ ਪੜ੍ਹਦੇ ਹੈ ਹਾਂਜੀ ਠੀਕ ਹਾਂਜੀ ਠੀਕ ਆ ਕੋਈ ਨਹੀਂ ਮੈਂ ਆ ਕੇ ਦੇਖਦੀ ਹਾਂ ਫਿਰ ਹੂੰ ਹਾਂ ਹੈਲੋ ਓਕੇ ਹਾਂਜੀ ਓਕੇ ਓਕੇ